ਸਰ ਮੇਰਾ ਨਾਮ ਕਿਸ਼ੋਰ ਕੁਮਾਰ ਹੈ ਮੈਂ ਪਿੰਡ ਮਿਰਜਾਪੁਰ ਦਾ ਰਹਿਣ ਵਾਲਾ ਹਾਂ ਵਾਸੀ ਜ਼ਿਲ੍ਹਾ ਪਠਾਨਕੋਟ ਅਤੇ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਔਨਲਾਈਨ ਵੀ ਚੀਜ਼ਾਂ ਅੱਜ ਕੱਲ੍ਹ ਮਿਲ ਜਾਂਦੀਆਂ ਮੈਂ ਸੋਚਿਆ ਕਿ ਮੈਂ ਵੀ ਕੋਈ ਚੀਜ਼ ਔਨਲਾਈਨ ਮੰਗਾਵਾਂ ਅਤੇ ਮੈਂ ਇੱਕ ਦਿਨ ਮੋਬਾਇਲ ਸਕਰੋਲ ਕਰ ਰਿਹਾ ਸੀ ਅਤੇ ਤੁਹਾਡੀ ਐਮਾਜੋਨ ਕੰਪਨੀ ਦਾ ਐਪ ਖੋਲ੍ਹਿਆ ਉਹਦੇ 'ਚ ਦੇਖਿਆ ਬਹੁਤ ਵਧੀਆ ਵਧੀਆ ਕੂਲਰ ਸਕਰੀਨ ਹੋ ਰਹੀ ਸੀ ਤਾਂ ਮੇਰਾ ਵੀ ਮਨ ਕੀਤਾ ਕਿ ਮੈਂ ਵੀ ਇੱਕ ਕੂਲਰ ਖਰੀਦਾ ਅਤੇ ਮੈਂ ਵਧੀਆ ਕਰਕੇ ਉਸ ਕੂਲਰ ਦੀ ਫੋਟੋ ਵਗੈਰਾ ਦੇਖੀ ਮੈਨੂੰ ਵਧੀਆ ਲੱਗਿਆ ਅਤੇ ਮੈਂ ਉਸ ਕੂਲਰ ਨੂੰ ਔਡਰ ਕੀਤਾ ਔਡਰ ਪਲੇਸ ਕਰਨ ਵਾਸਤੇ ਟਾਈਮਿੰਗ ਮਿਲੀ ਸੀ ਮੈਨੂੰ ਸੱਤ ਦਿਨ ਦੀ ਪਰ ਤੁਹਾਡੀ ਕੰਪਨੀ ਦੀ ਡਿਲੀਵਰੀ ਜਿਹੜੀ ਸੀ ਬਹੁਤ ਜਲਦੀ ਸਪੀਡ ਸੀ ਅਤੇ ਉਹ ਕਾਫੀ ਦੋ ਤਿੰਨ ਦਿਨ ਪਹਿਲੇ ਹੀ ਉਹਨਾਂ ਨੇ ਡਿਲੀਵਰਡ ਕਰਤਾ ਅਤੇ ਫਿਰ ਮੈਂ ਉਸ ਕੂਲਰ ਦੀ ਪੈਕਿੰਗ ਨੂੰ ਘਰ ਆ ਕੇ ਖੋਲ੍ਹਿਆ ਖੋਲ੍ਹ ਕੇ ਦੇਖਿਆ ਕਿ ਬਹੁਤ ਵਧੀਆ ਉਹਨਾਂ ਨੇ ਪੈਕ ਕਰਕੇ ਭੇਜਿਆ ਹੋਇਆ ਸੀ ਇਹ ਪੈਕ ਅਤੇ ਉਸ ਨੂੰ ਖੋਲ੍ਹ ਕੇ ਦੇਖਿਆ ਕਲਰ ਵਗੈਰਾ ਵੀ ਵਧੀਆ ਸੀ ਸਟੈਂਡ ਵਗੈਰਾ ਵੀ ਵਧੀਆ ਸੀ ਜੀਲੇ ਉਹਨੂੰ ਚਲਾ ਕੇ ਵੇਖਿਆ ਚਲਾ ਕੇ ਵੇਖਿਆ ਤਾਂ ਉਸ ਦੀ ਅਹ ਹਵਾ ਵੀ ਠੀਕ ਸੀ ਅਤੇ ਨਾਲੇ ਉਹਦੀ ਪੰਪ ਵੀ ਬਹੁਤ ਵਧੀਆ ਵਰਕ ਕਰਦਾ ਪਿਆ ਸੀ ਅਤੇ ਨਾਲ ਨਾਲ ਉਹਨਾਂ ਦੀ ਸਵਿੰਗ ਸਿਸਟਮ ਵੀ ਦਿੱਤਾ ਹੋਇਆ ਸੀ ਮੈਂ ਇਹ ਬਹੁਤ ਵਧੀਆ ਲੱਗਾ ਕਿ ਉਹਦੇ ਵਿੱਚ ਇੱਕ ਡਰੇਨ ਦਾ ਸਿਸਟਮ ਬਹੁਤ ਵਧੀਆ ਨਵਾਂ ਫੀਚਰ ਦਿੱਤਾ ਸੀ ਜਿਸ ਨੂੰ ਪੰਪ ਔਨ ਕਰਨ 'ਤੇ ਡਰੇਨ ਕੀਤਾ ਜਾਇਆ ਜਾਂਦਾ ਸੀ ਬਹੁਤ ਵਧੀਆ ਲੱਗਿਆ ਥੈਂਕ ਯੂ